ਜਿਨ੍ਹਾਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਪੰਜਾਬੀ ਲੋਕ ਆਪਣੀ ਭਾਸ਼ਾ ਦੀ ਵਰਤੋਂ ਨਾਲ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਪੰਜਾਬੀ ਲੋਕ ਬੜੇ ਖੁੱਲ੍ਹੇ ਦਿਲ ਦੇ ਮਾਲਕ ਹੁੰਦੇ ਹਨ ਹਰ ਵੇਲੇ ਸੇਵਾ ਕਰਨ ਦੀ ਭਾਵਨਾ ਨਾਲ ਤਿਆਰ ਰਹਿੰਦੇ ਹਨ ਪੰਜਾਬੀ ਲੋਕ ਇੱਕ ਇੱਕ ਅੱਖਰ ਨਾਲ ਹੌਲੀ ਹੌਲੀ ਬੋਲਦੇ ਹੋਏ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਆਮ ਵਰਤੋਂ ਦੇ ਸ਼ਬਦਾਂ ਦੀ ਉਹਨਾਂ ਨੂੰ ਜਾਣਕਾਰੀ ਦਿੰਦੇ ਨੇ ਪੰਜਾਬੀ ਭਾਸ਼ਾ ਅਤੇ ਦੂਸਰੀ ਭਾਸ਼ਾ ਵਿੱਚ ਇੱਕੋ ਜਿਹੇ ਰਲਦੇ ਮਿਲਦੇ ਹੁੰਦੇ ਹੋ ਹਨ ਉਹਨਾਂ ਸ਼ਬਦਾਂ ਨੂੰ ਪੰਜਾਬੀ ਲੋਕਾਂ ਨੂੰ ਸਮਝਾਉਣ ਵਿੱਚ ਬਹੁਤ ਜ਼ਿਆਦਾ ਅਸਾਨੀ ਹੁੰਦੀ ਹੈ ਕੁਝ ਨਵੇਂ ਸ਼ਬਦ ਉਹ ਦੂਜੀ ਭਾਸ਼ਾ ਤੋਂ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਹਨ ਜੋ ਕਿ ਬਾਕੀ ਭਾਸ਼ਾ ਵਾਲੇ ਲੋਕ ਵਰਤਦੇ ਹਨ